ਹੈਲੋ ਸਰ ਕੀ ਤੁਸੀਂ ਏ ਬੀ ਸੀ ਡੀ ਰੈਸਟੋਰੈਂਟ ਤੋਂ ਮੈਨੇਜਰ ਸਾਹਿਬ ਗੱਲ ਕਰ ਰਹੇ ਹੋ ਸਰ ਮੈਂ ਡਾਕਟਰ ਡੀ ਡੀ ਸਿੰਘ ਗੱਲ ਕਰ ਰਿਹਾਂ ਅਤੇ ਮੈਂ ਆਪਣੀ ਬੇਟੀ ਦੇ ਜਨਮਦਿਨ ਮਨਾਉਣ ਲਈ ਤੁਹਾਡੇ ਰੈਸਟੋਰੈਂਟ ਦੇ ਵਿੱਚ ਸ਼ਾਮ ਨੂੰ ਆਉਣਾ ਚਾਹੁੰਦਾ ਅਤੇ ਕਿਰਪਾ ਕਰਕੇ ਮੈਨੂੰ ਵੱਖ ਵੱਖ ਅੋਫਰਜ਼ ਜਾਂ ਪੇਸ਼ਕਸ਼ਾਂ ਜੋ ਕਿ ਟੇਬਲ ਅ ਰਿਜ਼ਰਵ ਕਰਵਾਉਣਾ ਚਾਹੁੰਦਾ ਮੈਂ ਤਾਂ ਉਹਦੇ ਉੱਤੇ ਕੀ ਕੀ ਅੋਫਰਜ਼ ਹਨ ਖਾਣੇ ਦੇ ਉੱਤੇ ਅਤੇ ਕੀ ਡਿਸਕਾਊਂਟ ਹੈ ਜੋ ਤੁਸੀਂ ਅੋਫਰ ਕਰ ਰਹੇ ਹੋ ਹਾਂਜੀ ਸਰ ਅਸੀਂ ਤਕਰੀਬਨ ਦਸ ਤੋਂ ਬਾਰ੍ਹਾਂ ਜਾਣੇ ਅ ਮੈਂਬਰਸ ਅੱਜ ਦੀ ਸ਼ਾਮ ਦੀ ਜੋ ਪਅ ਪਾਰਟੀ ਹੈ ਸਾਡੀ ਤਾਂ ਉਹਦੇ ਲਈ ਉੱਥੇ ਹੋਵਾਂਗੇ ਹਾਜ਼ਰ ਹੋਵਾਂਗੇ ਅਤੇ ਸਰ ਇਸ ਤੋਂ ਇਲਾਵਾ ਮੈਕਸੀਮਮ ਕੀ ਡਿਸਕਾਊਂਟ ਤੁਸੀਂ ਸਾਨੂੰ ਕਰ ਸਕਦੇ ਹੋ ਠੀਕ ਹੈ ਸਰ ਮੈਂ ਤੁਹਾਡੀਆਂ ਪੇਸ਼ਕਸ਼ਾਂ ਸੁਣ ਲਈਆਂ ਹਨ ਅਤੇ ਕਿਰਪਾ ਕਰਕੇ ਅੱਜ ਸ਼ਾਮ ਨੂੰ ਸੱਤ ਵਜੇ ਬਾਰ੍ਹਾਂ ਮੈਂਬਰਾਂ ਦੇ ਲਈ ਇੱਕ ਟੇਬਲ ਆਪਣੇ ਰੈਸਟੋਰੈਂਟ ਦੇ ਵਿੱਚ ਬੁੱਕ ਕਰ ਲਓ ਅਤੇ ਸ਼ਾਮ ਨੂੰ ਠੀਕ ਸੱਤ ਵਜੇ ਅਸੀਂ ਉੱਥੇ ਹੋਵਾਂਗੇ ਠੀਕ ਹੈ ਸਰ ਧੰਨਵਾਦ